ਤੁਸੀਂ ਢਿੱਲੋਂ ਟ੍ਰੈਵਲ ਤੋਂ ਗੱਲ ਕਰਦੇ ਹੋ ਅਸੀਂ ਪਟਿਆਲਾ ਦੇ ਦੁੱਖ ਨਿਵਾਰਨ ਗੁਰਦੁਆਰੇ ਵਿੱਚ ਘੁੰਮਣ ਜਾਣਾ ਸੀ ਅਸੀਂ ਪਰਿਵਾਰ ਦੇ ਪੰਜ ਛੇ ਮੈਂਬਰ ਅਤੇ ਦੋ ਤਿੰਨ ਮੇਰੇ ਦੋਸਤ ਹਨ ਅਸੀਂ ਇਕੱਠੇ ਕੱਲ੍ਹ ਨੂੰ ਉੱਥੇ ਜਾਣਾ ਸੀ ਘੁੰਮਣ ਗੁਰਦੁਆਰੇ ਵਿੱਚ ਤੁਸੀਂ ਸਾਨੂੰ ਇੱਥੇ ਕੋਈ ਗੱਡੀ ਬਾਰੇ ਦੱਸ ਸਕਦੇ ਹੋ ਜਿਵੇਂ ਕਿ ਵੱਡੀ ਗੱਡੀ ਜਿਵੇਂ ਇਨੋਵਾ ਜਾਂ ਟਵੇਰਾ ਜਾਂ ਕੋਈ ਵੀ ਵੱਡੀ ਗੱਡੀ ਹੋਵੇ ਉਹਦੇ ਬਾਰੇ ਅਤੇ ਕਿੰਨੇ ਕੁ ਪੈਸੇ ਵਿੱਚ ਹੋ ਜਾਵੇਗੀ ਅਤੇ ਉਸ ਬਾਰੇ ਮੈਂ ਜਾਣਕਾਰੀ ਲੈਣਾ ਚਾਹੁੰਦਾ ਸੀ ਤੁਹਾਨੂੰ ਅਤੇ ਕਿੰਨੇ ਕੁ ਵਜੇ ਤੱਕ ਤੁਸੀਂ ਸਾਨੂੰ ਗੱਡੀ ਇੱਥੇ ਘਰ ਭੇਜ ਸਕਦੇ ਹੋ ਅਤੇ ਕਿੰਨੇ ਕੁ ਟਾਈਮ ਲਈ ਭੇਜ ਸਕਦੇ ਹੋ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਵਾਂ ਮੈਂ ਤੁਹਾਨੂੰ ਅਤੇ ਜੇ ਤੁਸੀਂ ਕੋਈ ਛੂਟ ਵੀ ਦੇ ਸਕਦੇ ਹੋ ਤਾਂ ਵੀ ਤੁਸੀਂ ਦੱਸ ਦਿਓ ਮੈਨੂੰ ਕਿਉਂਕਿ ਅਸੀਂ ਦਸ ਬਾਰ੍ਹਾਂ ਪੂਰੇ ਪਰਿਵਾਰ ਦੇ ਮੈਂਬਰ ਹਨ